ਅਸੀਂ ਇੱਕ ਸਰਕਾਰੀ ਐਪ ਦੀ ਵਰਤੋਂ ਕਰਦੇ ਹਾਂ ਜੋ ਕਿ ਹੈ ਬੀਮ ਯੂ ਪੀ ਆਈ ਉਸ ਦੀ ਮਦਦ ਨਾਲ ਅਸੀਂ ਇੱਕ ਦੂਜੇ ਨੂੰ ਪੈਸੇ ਭੇਜ ਸਕਦੇ ਹਾਂ ਕਿਸੇ ਕੋਲੋਂ ਪੈਸੇ ਮੰਗਵਾ ਵੀ ਸਕਦੇ ਹਾਂ